ਭਾਰਤੀ ਸ਼ੈਲੀਆਂ ਦੇ ਵਿੱਚ ਇੱਕ ਤਾਂ ਪੰਜਾਬ 'ਚ ਭਾਈ ਸੱਭਿਆਚਾਰਕ ਅਲੋਪ ਹੋ ਰਿਹਾ ਹੈ ਸਾਰਾ ਦੂਜਾ ਹੈਗਾ ਅੱਧਾ ਇੰਡੀਆ ਤਾਂ ਬਾਹਰ ਚਲੇ ਗਿਆ ਕਨੇਡਾ ਆਸਟ੍ਰੇਲੀਆ ਫੋਰਨ 'ਚ ਇੱਥੇ ਇਹਦੀਆਂ ਸਰਕਾਰਾਂ ਜਿਹੜੀਆਂ ਕੁਝ ਕਰ ਨਹੀਂ ਰਹੀਆਂ ਨਾ ਹੀ ਇੱਥੇ ਬੰਦਾ ਸੇਫ ਆ ਕੋਈ ਇਹਨਾਂ ਨੂੰ ਸਾਂਭ ਸੰਭਾਲਣ ਦੀ ਬਹੁਤ ਲੋੜ ਆ ਅਤੇ ਇੱਕ ਉਰੇ ਬੇਰੁਜ਼ਗਾਰੀ ਕਰਕੇ ਅੱ ਸਾਰਾ ਇੰਡੀਆ ਖਾਲੀ ਹੋ ਰਿਹਾ ਨੌਕਰੀਆਂ ਹੈ ਨਹੀਂ ਗਰੀਬੀ ਵਧੀ ਜਾ ਰਹੀ ਆ ਅਤੇ ਹਲਾ ਆਪਣੇ ਪੈਸੇ ਘਰ ਨੂੰ ਘਰ ਦੀ ਪਾਲਣ ਪੋਸ਼ਣ ਵਾਸਤੇ ਬਾਹਰ ਰੁਲ ਰਿਹਾ ਸੋ ਇਹ ਹੋਣੀਆਂ ਚਾਹੀਦੀਆਂ ਬੇਰੁਜ਼ਗਾਰੀ ਖਤਮ ਹੋਵੇ ਅਤੇ ਇੱਧਰ ਜੇ ਸਾਧਨ ਹੋਣ ਕਮਾਈ ਦੇ ਤਾ ਕਾਹਨੂੰ ਬਾਹਰ ਜਾਵੇ ਬੰਦਾ ਇਹ ਇਹ ਪਹਿਲਾਂ ਚਾਹੀਦਾ